ਮੇਰੇ ਕੋਲ ਸਿਲਾਈ ਕਢਾਈ ਕਰਨ ਲਈ ਥੋੜ੍ਹੀਆਂ ਮਸ਼ੀਨਾਂ ਹਨ ਜਿਵੇਂ ਕਿ ਇੰਟਰਲੋਕ ਦੀ ਮਸ਼ੀਨ ਪੀਕੋ ਦੀ ਮਸ਼ੀਨ ਕਢਾਈ ਕਰਨ ਲਈ ਮਸ਼ੀਨ ਮੇਰੇ ਕੋਲ ਇਹ ਮਸ਼ੀਨਾਂ ਤਾਂ ਹਨ ਅਸਲ ਵਿੱਚ ਮੈਨੂੰ ਹੋਰ ਵੀ ਮਸ਼ੀਨਾਂ ਦੀ ਜ਼ਰੂਰਤ ਹੈ ਜਿਵੇਂ ਕਿ ਮੇਰੇ ਕੋਲ ਜਿਵੇਂ ਕੰਮ ਹੁੰਦਾ ਹੈ ਮੈਂ ਇਹ ਕੰਮ ਟਾਈਮ ਨਾਲ ਨਹੀਂ ਕਰ ਪਾਉਂਦੀ ਇਹਨਾਂ ਮਸ਼ੀਨਾਂ ਨਾਲ ਮੈਨੂੰ ਮੋਟਰ ਵਾਲੀਆਂ ਮਸ਼ੀਨਾਂ ਦੀ ਜ਼ਰੂਰਤ ਹੈ ਜਿਹਨਾਂ ਨਾਲ ਮੈਂ ਆਪਣਾ ਕੰਮ ਸਮੇਂ ਸਿਰ ਕਰ ਸਕਾਂ ਅਤੇ ਲੋਕਾਂ ਨੂੰ ਉਨ੍ਹਾਂ ਦਾ ਕੰਮ ਸਹੀ ਜਿਹੜਾ ਸਮਾਂ ਮੈਂ ਉਨ੍ਹਾਂ ਨੂੰ ਕਿਹਾ ਹੈ ਉਸ ਸਮੇਂ 'ਤੇ ਮੈਂ ਉਨ੍ਹਾਂ ਨੂੰ ਉਹ ਦੇ ਸਕਾਂ ਅਤੇ ਅਸਲ ਵਿੱਚ ਮੈਨੂੰ ਮਸ਼ੀਨਾਂ ਦੀ ਜ਼ਰੂਰਤ ਤਾਂ ਹੈ ਅੱਜ ਕੱਲ੍ਹ ਤਾਂ ਬਹੁਤ ਨਵੀਆਂ ਤਰੀਕਾਂ ਦੀਆਂ ਮਸ਼ੀਨਾਂ ਤਕਨੀਕਾਂ ਦੀਆਂ ਮਸ਼ੀਨਾਂ ਆ ਗਈਆਂ ਹਨ ਇਹ ਮੋਟਰ ਹਰੇਕ ਮਸ਼ੀਨ 'ਤੇ ਮੋਟਰ ਮੋਟਰ ਵਾਲੀਆਂ ਮਸ਼ੀਨਾਂ ਨਾਲ ਬਹੁਤ ਕੰਮ ਅਸਾਨ ਹੋ ਜਾਂਦਾ ਹੈ ਮੇਰੇ ਕੋਲ ਪੈਰਾਂ ਨਾਲ ਗੇੜਨ ਵਾਲੀ ਮਸ਼ੀਨ ਹੈ ਇਸ ਨਾਲ ਮੈਂ ਕੰਮ ਕਰਦੇ ਕਰਦੇ ਬਹੁਤ ਥੱਕ ਵੀ ਜਾਂਦੀ ਹਾਂ ਅਸਲ ਵਿੱਚ ਮੈਂ ਆਪਦੇ ਕਸਟਮਰਜ਼ ਨੂੰ ਸਹੀ ਸਮੇਂ 'ਤੇ ਜਿਹੜਾ ਸਮਾਂ ਮੈਂ ਉਨ੍ਹਾਂ ਨੂੰ ਕਿਹਾ ਹੈ ਉਹ ਸਮੇਂ 'ਤੇ ਮੈਂ ਉਨ੍ਹਾਂ ਨੂੰ ਉਹ ਕੰਮ ਨਹੀਂ ਕਰਕੇ ਦੇ ਸਕਦੀ ਇਸ ਲਈ ਮੈਨੂੰ ਮੋਟਰ ਵਾਲੀਆਂ ਮਸ਼ੀਨਾਂ ਦੀ ਜ਼ਰੂਰਤ ਹੈ ਜਿਸ ਨਾਲ ਮੈਂ ਆਪਣਾ ਕੰਮ ਸਮੇਂ ਸਿਰ ਕਰ ਸਕਾਂ ਅਤੇ ਆਪਣੇ ਜਿਹੜੇ ਗਾਹਕ ਹੈ ਉਨ੍ਹਾਂ ਨੂੰ ਸਹੀ ਸਮੇਂ 'ਤੇ ਮੈਂ ਉਨ੍ਹਾਂ ਨੂੰ ਜਿਹੜਾ ਉਨ੍ਹਾਂ ਦਾ ਕੱਪੜਾ ਹੈ ਉਹ ਦੇ ਸਕਾਂ ਇਸ ਲਈ ਮੈਨੂੰ ਮੋਟਰ ਵਾਲੀਆਂ ਮਸ਼ੀਨਾਂ ਦੀ ਜ਼ਰੂਰਤ ਹੈ